ਜਦੋਂ ਕਦੇ ਵੀ ਸਾਨੂੰ ਬਾਹਰ ਜਾਣਾ ਪੈਂਦਾ ਹੈ ਤਾਂ ਪੌਦਿਆਂ ਦੀ ਸਾਂਭ ਸੰਭਾਲ ਇੱਕ ਸਮੱਸਿਆ ਬਣ ਜਾਂਦੀ ਹੈ ਅਸੀਂ ਜਦੋਂ ਵੀ ਪੌਦ ਬਾਹਰ ਜਾਂਦੇ ਹਾਂ ਕੁਝ ਦਿਨਾਂ ਲਈ ਤਾਂ ਪੌਦਿਆਂ ਦੇ ਅਸੀਂ ਆਲੇ ਦੁਆਲੇ ਇੱਕ ਪੰਨੀ ਦੇ ਤੌਰ 'ਤੇ ਉਹਨਾਂ ਜੜ੍ਹਾਂ 'ਚ ਲਾ ਰੱਖ ਜਾਂਦੇ ਹਾਂ ਪੰਨੀਆਂ ਨੂੰ ਗਿੱਲਾ ਕਰਕੇ ਤਾਂ ਜੋ ਉਹ ਪੰਜ ਚਾਰ ਦਿਨ ਜੇ ਬਾਹਰ ਰਹਿਣਾ ਪਵੇ ਤਾਂ ਉਹਨਾਂ ਨੂੰ ਪਾਣੀ ਪਾਣੀ ਪਾਣੀ ਤੋਂ ਥੋੜ੍ਹ ਨਾ ਆਵੇ ਕਿਉਂਕਿ ਪੰਨੀ ਹੈ ਜਿਹੜੀ ਉਹ ਜੜ੍ਹਾਂ ਨੂੰ ਸੁੱਕਣ ਨਹੀਂ ਦਿੰਦੀ ਹੈਗੀ ਉਹਦੇ ਵਿੱਚ ਆਪਦੇ ਪਾਣੀ 'ਚ ਜ ਪਾਣੀ ਸੁੱਕਣ ਦਾ ਜਜ਼ਬਾ ਹੁੰਦਾ ਹੈਗਾ ਦੋ ਚਾਰ ਦਿਨ ਬਰ ਲਈ ਉਹ ਪੌਦ ਪੌਦੇ ਨੂੰ ਕੁਝ ਵੀ ਨਹੀਂ ਹੋਣ ਦਿੰਦੀ ਇਸ ਤੋਂ ਇਲਾਵਾ ਜੋ ਗਰੀਨ ਕੱਪੜਾ ਆਉਂਦਾ ਉਹ ਵੀ ਅਸੀਂ ਉੱਪਰ ਪੌਦਿਆਂ ਦੇ ਲਾ ਕੇ ਜਾਂਦੇ ਹਾਂ ਤਾਂ ਜੋ ਪੌ ਪੌਦਿਆਂ ਨੂੰ ਸਿੱਧੀ ਧੁੱਪ ਦਾ ਸਾਹਮਣਾ ਨਾ ਕਰਨਾ ਪਵੇ ਜਦੋਂ ਸਿੱਧੀ ਧੁੱਪ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਵੀ ਪੌਦੇ ਜਲਦੀ ਪਾਣੀ ਭਾਲਦੇ ਨੇ ਅਤੇ ਇਸ ਤੋਂ ਇਲਾਵਾ ਵੀ ਇੱਕ ਦ ਹੋਰ ਹੋਰ ਕਾਦੇ ਕਾਰਨ ਕਾਰਨ ਹੁੰਦੇ ਨੇ ਵੀ ਪੌਦਿਆਂ ਨੂੰ ਛਾਂ ਵਿੱਚ ਰੱਖਣਾ ਅਤੇ ਪੌਦਿਆਂ ਦੇ ਉੱਤੇ ਹਰੀ ਪੱਟੀ ਬ ਰੱਖਣੀ ਪੌਦਿਆ ਦੀ ਜੜ੍ਹਾਂ ਦੇ ਵਿੱਚ ਪੰਨੀ ਉਹਨੂੰ ਛਿੜਕ ਜਾਣਾ ਅਤੇ ਇਹ ਹੀ ਅਸੀਂ ਉਪਾਅ ਕਰਦੇ ਹਾਂ ਤਾਂ ਜੋ ਪੌਦੇ ਆਪਣਾ ਸਹੀ ਸਲਾਮਤ ਰਹਿਣ ਅਤੇ ਆਪਣਾ ਹਫ਼ਤਾ ਹਫ਼ਤਾ ਦਸ ਦਿਨ ਪੌਦਿਆਂ ਨੂੰ ਕੁਝ ਵੀ ਨਾ ਹੋਵੇ ਇਸ ਇਸ ਤਰ੍ਹਾਂ ਦੀ ਦੇਖਭਾਲ ਕਈ ਵਾਰ ਗੁਆਂਢੀ ਨੂੰ ਵੀ ਕੋਈ ਸਾਡਾ ਆਂਢ ਗੁਆਂਢ 'ਚ ਜੋ ਹੁੰਦਾ ਉਸ ਨੂੰ ਵੀ ਉਸ ਦੀ ਡਿਊਟੀ ਲਗਾ ਜਾਈਦੀ ਆ ਵੀ ਚੌਥੇ ਪੰਜਵੇਂ ਦਿਨ ਪੰਜ ਚਾਰ ਦਿਨਾਂ ਬਾਅਦ ਉਹਨੂੰ ਪਾਣੀ ਦਿੰਦਾ ਰਹੇ ਇਹ ਹੀ ਅਸੀਂ ਕ ਦੇਖਭਾਲ ਇਸ ਤਰ੍ਹਾਂ ਦੀ ਕਰ ਰਹੇ ਹੋਉਂਗੇ